ਮੈਂ ਪ੍ਰੇਮ ਸਿੰਘ ਗਾਓਂ ਮਿਰਜ਼ਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਬੁਣਾਈ ਅਤੇ ਸਿਲਾਈ ਦੀ ਬਹੁਤ ਹੀ ਮਹੱਤਵਪੂਰਨ

ਬੁਣਾਈ ਇੱਕ ਬਹੁਤ ਹੀ ਵਧੀਆ ਸਾਧਨ ਹੈ ਜਿਸ ਦੇ ਵਿੱਚ ਸਿਲਾਈ ਬਣਾਉਣਾ ਜਾਂ ਉੱਨ ਦੀ ਸਿਲਾਈ ਉੱਨ ਬਣਾਉਣਾ ਅਤੇ ਇਸ ਦੇ ਵਿੱਚ ਟੂਲ ਜਿਹੜੇ ਕਿ ਜਿੱਦਾਂ ਸਿਲਾਈ ਮਸ਼ੀਨ ਦੇ ਵਿੱਚ ਕਈ ਤਰ੍ਹਾਂ ਦੇ ਟੂਲ ਲੱਗਦੇ ਹਨ ਥਰੈੱਡ ਜੋ ਕਿ ਉਸ ਦੇ ਵਿੱਚ ਧਾਗਾ ਪ ਪਾਇਆ ਜਾਂਦਾ ਹੈ ਮਸ਼ੀਨ ਦੇ ਵਿੱਚ ਧਾਗਾ ਪਾਇਆ ਜਾਂਦਾ ਹੈ ਅਤੇ ਉੱਨ ਜਿਹੜਾ ਕਿ ਅਸੀਂ ਸਿਲਾਈ ਸਲਾਈਆਂ ਦੇ ਨਾਲ ਸਵੈਟਰ ਬਣਾਉਣਾ ਜਾਂ ਹੋਰ ਖਰੋਸ਼ੀਏ ਨਾਲ ਕਈ ਚੀਜ਼ਾਂ ਉੱਨ ਦੇ ਨਾਲ ਬਣਾਈਆਂ ਜਾਂਦੀਆਂ ਹਨ ਮਸ਼ੀਨ ਇੱਕ ਬਹੁਤ ਹੀ ਅੱਛਾ ਸਾਧਨ ਹੈ ਜੋ ਕਿ ਇਸਦੇ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਾਂ ਹਨ ਮਸ਼ੀਨ ਦੀ ਮਸ਼ੀਨਰੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਸ ਦੇ ਨਾਲ ਅਸੀਂ ਬਹੁਤ ਹੀ ਅੱਛੇ ਤਰ੍ਹਾਂ ਦਾ ਡਿਜ਼ਾਇਨ ਅਤੇ ਸਿਲਾਈ ਬੁਣਾਈ ਕਰ ਸਕਦੇ ਹਾਂ ਬਣਨ ਬਣਨ ਲਈ ਤੁਸੀਂ ਹੋਰ ਵਧੀਆ ਢੰਗ ਦੇ ਨਾਲ ਕਰਨ ਵਾਸਤੇ ਸਾਨੂੰ ਮਸ਼ੀਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਮਸ਼ੀਨ ਇੱਕ ਇਹੋ ਜਿਹਾ ਜ਼ਰੀਆ ਹੈ ਜਿਸ ਦੇ ਨਾਲ ਅਸੀਂ ਵਧੀਆ ਤੋਂ ਵਧੀਆ ਕੰਮ ਕਰ ਸਕਦੇ ਹਾਂ ਅਤੇ ਬੁਣਾਈ ਦਾ ਕੰਮ ਅਸੀਂ ਮਸ਼ੀਨਾਂ ਤੋਂ ਅੱਛਾ ਤੋਂ ਅੱਛਾ ਅਤੇ ਅੱਛੀ ਤੋਂ ਚੰਗੀ ਤਰ੍ਹਾਂ ਦਾ ਕੰਮ ਕਰ ਸਕਦੇ ਹਾਂ ਸਿਲਾਈ ਇੱਕ ਜਿਹੜੀ ਘਰ ਦੇ ਵਿੱਚ ਅਸੀਂ ਸਿਲਾਈ ਮਸ਼ੀਨ ਰੱਖੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਕੱਪੜੇ ਸਿਊਣ ਦਾ ਵੀ ਕੰਮ ਕਰਦੇ ਹਾਂ ਅਤੇ ਹੋਰ ਵੀ ਕਈ ਕੰਮ ਲੈ ਸਕਦੇ ਹਾਂ ਜਿੱਦਾਂ ਪਰਦੇ ਸਿਊਣਾ ਫਿਰ ਕੱਪੜੇ ਸਿਊਣਾ ਕਿਤਾਬਾਂ ਸਿਊਣੀਆਂ ਇਹਨਾਂ ਵਿੱਚ ਬਹੁਤ ਹੀ ਮਹੱਤਵਪੂਰਨ ਚੀਜ਼ਾਂ ਆਉਂਦੀਆਂ ਹਨ ਅਸੀਂ ਕਈ ਵਾਰ ਆਪਣੇ ਫਟੇ ਪੁਰਾਣੇ ਕੱਪੜੇ ਜਿਹੜੇ ਆ ਉਹਨਾਂ ਨੂੰ ਵਧੀਆ ਢੰਗ ਨਾਲ ਮਸ਼ੀਨ ਦੀ ਮਦਦ ਨਾਲ ਅਸੀਂ ਵਧੀਆ ਢੰਗ ਨਾਲ ਉਸਨੂੰ ਜਿੱਦਾਂ ਸਰ੍ਹਾਣਿਆਂ ਦੇ ਕਵਰ ਜਾਂ ਹੋਰ ਕੁਝ ਬਣਾ ਸਕਦੇ ਹਾਂ ਪਰਦੇ ਬਣਾ ਸਕਦੇ ਹਾਂ ਸਿਲਾਈ ਮਸ਼ੀਨਾਂ ਨਾਲ ਇਸ ਤੋਂ ਵਧੀਆ ਬਣਾਉਣ ਵਾਸਤੇ ਅਸੀਂ ਕਈ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ ਥੈਂਕ ਯੂ ਜੀ